ਜੇਕਰ ਧਾਰਮਿਕ ਤਿਉਹਾਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਿਹੜੀ ਗੁਰਪੁਰਬ ਹੈ ਬੜੇ ਹੀ ਧੂਮ ਧਾਮ ਦੇ ਨਾਲ਼ ਮਨਾਈ ਜਾਂਦੀ ਹੈ ਗੁਰਪੁਰਬ ਦੇ ਟਾਈਮ 'ਤੇ ਜਦੋਂ ਸੁਬਹ ਸੁਬਹ ਉੱਠ ਕੇ ਅਸੀਂ ਅ ਗੁਰਦੁਆਰਿਆਂ ਦੇ ਵਿੱਚ ਜਾ ਕੇ ਸੇਵਾ ਕਰਦੇ ਹਾਂ ਉ ਉ ਗੁਰਦੁਆਰਿਆਂ ਦੀ ਸਾਜ ਸਜਾਵਟ ਹੈ ਜਿਹੜੀ ਕਿ ਕੀਤੀ ਜਾਂਦੀ ਹੈ ਅਤੇ ਇਸ ਮੌਕੇ 'ਤੇ ਗੁਰਦੁਆਰਿਆਂ ਦਾ ਜਿਹੜਾ ਦ੍ਰਿਸ਼ ਹੈ ਉਹ ਦੇਖਣ ਵਾਲ਼ਾ ਹੁੰਦਾ ਹੈ ਅਤੇ ਜਿਹੜੀ ਸੰਗਤ ਹੈ ਉਹ ਆਪਣੇ ਆਪਣੇ ਘਰ ਤੋਂ ਦੇਗ ਬਣਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਾਉਂਦੀ ਹੈ ਅਤੇ ਹੋਰ ਵੀ ਜਿਹੜੀਆਂ ਮਿਠਾਈਆਂ ਨੇ ਉਸਦਾ ਆਨੰਦ ਮਾਣਿਆ ਜਾਂਦਾ ਪਰ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਇਹ ਭੋਗ ਲਵਾਇਆ ਜਾਂਦਾ ਅਤੇ ਉਸਦੇ ਬਾਅਦ ਵਿੱਚ ਹੀ ਜਿਹੜੀ ਇਹ ਸੰਗਤ ਦੇ ਵਿੱਚ ਹੈ ਇਹ ਵਰਤਾਈ ਜਾਂਦੀ ਹੈ